ਟਰੈਕਿੰਗ ਮੇਰੀ ਹੋਬੀ ਹੈ ਅਤੇ ਮੈਂ ਟਰੈਕਿੰਗ ਕਰਨਾ ਮੈਨੂੰ ਬਹੁਤ ਪਸੰਦ ਆ ਮੈਂ ਆਪਣੇ ਨਿੱਜੀ ਕੰਮ ਦੇ ਵਿੱਚ ਔਰ ਜ਼ਿੰਦਗੀ ਵਿੱਚ ਟਰੈਕਿੰਗ ਕਰਨ ਵਾਸਤੇ ਕੁਝ ਸਮਾਂ ਕੱਢ ਲੈਂਦਾ ਹੈਗਾ ਜਿਹਦੇ ਵਿੱਚ ਕਿ ਮੇਰੇ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਹੈ ਪਰਿਵਾਰ ਵਾਲਿਆਂ ਨੂੰ ਪਤਾ ਕਿ ਇਹਦੀ ਹੋਬੀ ਹੈ ਟਰੈਕਿੰਗ ਕਰਨਾ ਚਾਹਦੇ ਸਰੀਰ ਵਾਸਤੇ ਵੀ ਸਹੀ ਰਹਿੰਦਾ ਆ ਠੀਕ ਹੈ ਅਤੇ ਮੋਸ ਜ਼ਿਆਦਾਤਰ ਮੈਂ ਦੋਸਤਾਂ ਨਾਲ ਹੀ ਜ਼ਿਆਦਾ ਟਰੈਕਿੰਗ ਕਰਨ ਜਾਂਦਾ ਹਾਂ ਅਤੇ ਦੋਸਤਾਂ ਦਾ ਸਾਥ ਪੂਰਾ ਮਿਲਦਾ ਹੈ ਆਪਾਂ ਬਹੁਤ ਸਾਰੀ ਜਗ੍ਹਾ ਟ੍ਰੇਕਿੰਗ ਕੀਤੀ ਹੈ ਹੁਣ ਥੋੜ੍ਹੇ ਦੇਰ ਪਹਿਲੇ ਹੀ ਆਪਾਂ ਇਸੀ ਮਹੀਨੇ ਜੂਨ ਦੇ ਵਿੱਚ ਟਰੈਕਿੰਗ ਕਰਕੇ ਆਏ ਹਾਂ ਡਲਹੌਜੀ ਇਹਦੇ ਵਿੱਚ ਮੇਰੇ ਵੀਹ ਤੋਂ ਪੱਚੀ ਫਰੈਂਡ ਸੀਗੇ ਨਾਲ ਅਸੀਂ ਸਾਰਿਆਂ ਨੇ ਮਿਲ ਕੇ ਕਾਫੀ ਅੱਛਾ ਟਰੈਕ ਕਰਿਆ ਅਤੇ ਪਰਿਵਾਰ ਵੱਲੋਂ ਵੀ ਪੂਰਾ ਸਹਿਯੋਗ ਮਿਲਿਆ ਅਤੇ ਸਾਡੀ ਨਿੱਜੀ ਜ਼ਿੰਦਗੀ 'ਚ ਵੀ ਸ ਕਾਫੀ ਸਮਾਂ ਮਿਲਿਆ ਟਰੈਕਿੰਗ ਕਰਨ ਦਾ ਅੱਛਾ ਰਿਹਾ ਇਕ ਬਹੁਤ ਹੀ ਅੱਛਾ ਅਨੁਭਵ ਰਿਹਾ ਟਰੈਕਿੰਗ ਦਾ ਅਤੇ ਸਾਨੂੰ ਪਰਿਵਾਰ ਅਤੇ ਦੋਸਤ ਦਾ ਪੂਰਾ ਸਾਥ ਮਿਲਦਾ ਹੈ ਟਰੈਕਿੰਗ ਵਿਚ ਇੱਕ ਬਹੁਤ ਹੀ